ਅਸੀਂ ਰੋਜ਼ ਸੁਬਹਾ ਉੱਠ ਕੇ ਯੋਗਾ ਕਰ ਸਕਦੇ ਹਾਂ ਸਾਨੂੰ ਸੁਬਹਾ ਅੰਮ੍ਰਿਤ ਵੇਲੇ ਉੱਠ ਕੇ ਕਸਰਤ ਅਤੇ ਯੋਗਾ ਕਰਨਾ ਚਾਹੀਦਾ ਹੈ ਯੋਗਾ ਦੇ ਵਿੱਚ ਕਪਾਲਭਾਤੀ ਅਤੇ ਹੋਰ ਕਿਰਿਆਵਾਂ ਆਪਾਂ ਕਰ ਸਕਦੇ ਹਾਂ ਆਪਣੇ ਰੋਜ਼ਾਨਾ ਰੂਟੀਨ ਬਹੁਤ ਬਿਜ਼ੀ ਹੁੰਦਾ ਹੈ ਰੁਝਾਵ ਵਾਲਾ ਹੁੰਦਾ ਆਪਾਂ ਇੱਦਾਂ ਹੀ ਰੁੱਝੇ ਰਹਿਨੇ ਹੈ ਕੰਮਾਂ ਕਾਰਾਂ ਦੇ ਵਿੱਚ ਤਾਂ ਆਪਾਂ ਨੂੰ ਥੋੜ੍ਹਾ ਟਾਈਮ ਕੱਢ ਕੇ ਯੋਗਾ ਤਾਂ ਕਰਨਾ ਚਾਹੀਦਾ ਅਤੇ ਯੋਗਾ ਦਾ ਆਪਾਂ ਨੂੰ ਫਾਇਦਾ ਆਪਣੀ ਸਿਹਤ ਨੂੰ ਹੀ ਹੋਊਗਾ ਅੱਜ ਕੱਲ੍ਹ ਤਾਂ ਬਸ ਇਹ ਦੌੜ ਹੈਗੀ ਹੈ ਸੁਬਹਾ ਉੱਠੋ ਤਿਆਰ ਹੋ ਆਫਿਸ ਨੂੰ ਭੱਜੋ ਕੰਮ ਕਾਰ ਕਰੋ ਆਪਾਂ ਨੂੰ ਖੁਦ ਹੀ ਮੈਨੇਜਮੈਂਟ ਕਰਕੇ ਟਾਈਮ ਕੱਢਣਾ ਪੈਣਾ